ਪੰਜਾਬੀ ਸੱਭਿਆਚਾਰ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਪਰੰਤੂ ਜੇਕਰ ਅਜੋਕੀ ਖੇਤੀਬਾੜੀ ਦਾ ਹਾਲ ਦੇਖਿਆ ਜਾਵੇ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਮਹਿੰਗੀਆਂ ਰੇਹਾਂ ਸਪਰੇਆਂ ਹੋਣ ਦੇ ਕਾਰਨ ਜੋ ਲਾਗਤ ਮੁੱਲ ਹੈ ਉਹ ਵੀ ਵਾਪਸ ਨਹੀਂ ਮਿਲਦਾ ਇਸ ਲਈ ਕਈ ਕਿਸਾਨ ਖੁਦਕੁਸ਼ੀਆਂ ਵੀ ਕਰ ਰਹੇ ਹਨ ਕਿਉਂਕਿ ਜੋ ਉਧਾਰੇ ਫੜ੍ਹੇ ਹੋਏ ਪੈਸੇ ਹੋਏ ਹੁੰਦੇ ਹਨ ਉਹ ਵੀ ਵਾਪਸ ਨਹੀਂ ਹੋ ਪਾਉਂਦੇ ਕਿਸਾਨਾਂ ਨੇ ਸ਼ਹਿਰਾਂ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਆਖਦੇ ਹਨ ਕਿ ਖੇਤੀਬਾੜੀ ਨਾਲੋਂ ਕਿਸੇ ਹੋਰ ਕੰਮ ਧੰਦੇ ਵਿੱਚ ਆਪਣਾ ਪੈਰ ਜਮਾ ਲਿਆ ਜਾਵੇ ਕਿਉਂਕਿ ਕ ਅ ਕਿਸਾਨੀ ਵਿੱਚ ਤਾਂ ਲਾਗਤ ਮੁੱਲ ਵੀ ਵਾਪਸ ਨਹੀਂ ਮੁੜਦਾ ਹੈ